ਹੈਲੋ ਸਤਿ ਸ਼੍ਰੀ ਅਕਾਲ ਵੀਰ ਜੀ ਤੁਹਾਡੇ ਤੋਂ ਕੂਲਰ ਮੰਗਵਾਇਆ ਸੀਗਾ ਅਤੇ ਬਹੁਤ ਵਧੀਆ ਕੂਲਰ ਆਇਆ ਪਲਾਸਟਕ ਦੀ ਬਾਡੀ ਵਾਲਾ ਕੂਲਰ ਆਇਆ ਨਾ ਕੋਈ ਉਹਦੇ 'ਚ ਕਰੰਟ ਦਾ ਸਾਨੂੰ ਡਰ ਹੈ ਨਾ ਕੋਈ ਬੱਚਾ ਹੱਥ ਲਾ ਲਵੇ ਉਹ ਡਰ ਹੈ ਜੋ ਤੁਸੀਂ ਚੀਜ਼ਾਂ ਦੱਸੀਆਂ ਸੀ ਉਹ ਹੀ ਆਈਆਂ ਵੀ ਜੇਕਰ ਅਸੀਂ ਪਹਿਲਾਂ ਆਈਲੋਨ ਵੀ ਚੀਜ਼ ਮਸੀਨ ਮੰਗਵਾਈ ਸੀ ਕੱਪੜੇ ਧੋਣ ਵਾਲੀ ਉਹ ਸਾਨੂੰ ਨਹੀਂ ਫਿਟ ਆਈ ਅਤੇ ਨਹੀਂ ਸਾਡੇ ਠੀਕ ਨਹੀਂ ਆਈ ਉਹ ਸਾਡੇ ਪੈਸੇ ਡੁੱਬ ਗਏ ਅਤੇ ਜਿੰਨਾ ਚਿਰ ਇਹ ਕੂਲਰ ਆਇਆ ਨਹੀਂ ਤਾਂ ਸਾਨੂੰ ਉੰਨਾ ਚਿਰ ਡਰ ਹੀ ਰਿਹਾ ਵੀ ਉਹਦੇ ਵਾਂਗ ਕਿਤੇ ਸਾਡੇ ਪੈਸੇ ਫਿਰ ਨਾ ਡੁੱਬ ਜਾਣ ਅਤੇ ਸਾਡੀ ਚੀਜ਼ ਕੋਈ ਫਿਰ ਚੰਗੀ ਨਾ ਨਿਕਲੀ ਤਾਂ ਸਾਡੇ ਪੈਸੇ ਡੁੱਬ ਗਏ ਤਾਂ ਅਸੀਂ ਵੀ ਕੀ ਕਰਾਂਗੇ ਤਾਂ ਪਰ ਬਹੁਤ ਵਧੀਆ ਕੂਲਰ ਆ ਆਇਆ ਅਤੇ ਜੋ ਵਧੀਆ ਤੁਸੀਂ ਤਾਰ ਦਿੱਤੀ ਡਬਲ ਹੀ ਤਾਰ ਹੈ ਸਾਨੂੰ ਕੋਈ ਹੋਰ ਤਾਰ ਨਾਲ ਲਗਾਉਣ ਦੀ ਵੀ ਕੋਈ ਲੋੜ ਨਹੀਂ ਅਤੇ ਵਧੀਆ ਦੇ ਵਿੱਚ ਨਾ ਕੋਈ ਕਰੰਟ ਦਾ ਡਰ ਆ ਅਤੇ ਨਾ ਕਿਸੇ ਦਾ ਬਹੁਤ ਵਧੀਆ ਕੂਲਰ ਹੈ ਵਧੀਆ ਸਮਾਨ ਜੋ ਦੱਸਿਆ ਸੀ ਉਹ ਹੀ ਆਇਆ ਧੰਨਵਾਦ ਵੀਰ ਤੁਹਾਡਾ